ਪੰਜਾਬ 'ਚ ਜ਼ ਜ਼ਿਆਦਾਤਰ ਜੀ ਫੁਟਬਾਲ ਖੇਡੀ ਜਾਂਦੀ ਆ ਉਸ ਤੋਂ ਇਲਾਵਾ ਕ੍ਰਿਕਟ ਟੈਨਿਸ ਬੈਡਮਿੰਟਨ ਵੀ ਬਹੁਤ ਖੇਡਿਆ ਜਾਂਦਾ ਉਸ ਤੋਂ ਬਾਅਦ ਲੋਕਲ ਜਿਵੇਂ ਕੁਸ਼ਤੀਆਂ ਵਗੈਰਾ ਵੀ ਲੋਕ ਕਰਦੇ ਨੇ ਉਹ ਲੜਕੀਆਂ ਪੀਚੋ ਲੂਡੋ ਵਗੈਰਾ ਵੀ ਖੇਡਦੀਆਂ ਨੇ ਸ ਜ਼ਿਆਦਾਤਰ ਅ ਮੈਨੂੰ ਜਿਹੜਾ ਹੈ ਸ਼ੌਕ ਉਹ ਕ੍ਰਿਕਟ ਦਾ ਹੈ ਜਿਹਦੇ ਵਿੱਚ ਗਿਆਰਾਂ ਗਿਆਰਾਂ ਵਿਦਿਆ ਟੀਮਾਂ ਹੁੰਦੀਆਂ ਨੇ ਦੋਨਾਂ ਪਾਸੇ ਗਿਆਰਾਂ ਗਿਆਰਾਂ ਜਿਹੜੇ ਬੰਦੇ ਹੁੰਦੇ ਨੇ ਇੱਕ ਇੱਕ ਟੀਮ ਦੇ ਵਿੱਚ ਅਤੇ ਇੱਕ ਉਹਨਾਂ ਦਾ ਕਪਤਾਨ ਹੁੰਦਾ ਹੈ ਜਿਹਨੂੰ ਰੈਫਰੀ ਵੀ ਕਹਿ ਦਿੰਦੇ ਹਾਂ ਅਤੇ ਕਿ ਬੈਡਮਿੰਟ ਕ੍ਰਿਕਟ ਦੇ ਨਾਲ ਮੈਨੂੰ ਕਾਫੀ ਖੇਡਣ ਦਾ ਮੈਨੂੰ ਜਿਹੜਾ ਹੈ ਬਹੁਤ ਸ਼ੌਕ ਹੈ